ਪੰਜ ਲੱਖ ਤਰਤਾਲੀ ਹਜ਼ਾਰ ਦੋ ਸੌ ਬੱਤੀ ਚਾਰ ਲੱਖ ਬਵੰਜਾ ਹਜ਼ਾਰ ਤਿੰਨ ਸੌ ਤੇਰਾਂ ਪੰਜ ਲੱਖ ਤੇਈ ਹਜ਼ਾਰ ਚਾਰ ਸੌ ਸੋਲਾਂ ਤੇਰਾਂ ਲੱਖ ਛੱਬੀ ਹਜ਼ਾਰ ਸੱਤ ਸੌ ਉੱਨੀ ਤੇਈ ਲੱਖ ਪੱਚੀ ਹਜ਼ਾਰ ਨੌ ਸੌ ਵੀਹ